ਮੈਂ ਕਾਲੇ ਕੌਰ ਮੇਰਾ ਅੱਜ ਸੰਗਰੂਰ ਵਿੱਚ ਪੇਪਰ ਸੀ ਮੈਂ ਸੰਗਰੂਰ ਤੋਂ ਵਾਪਸ ਫਫੜੇ ਭਾਈ ਕੇ ਆਉਂਦੇ ਸਮੇਂ ਇੱਕ ਕੈਬ ਬੁੱਕ ਕਰਵਾਈ ਸੀ ਜਿਸ ਵਿੱਚ ਮੇਰੇ ਕੋਲ ਪਰਸ ਸੀ ਮੇਰ ਮੈਨੂੰ ਕੈਬ ਦੇ ਵਿੱਚ ਬੈਠੀ ਨੂੰ ਇੱਕ ਫੋਨ ਕੌਲ ਆਈ ਮੈਂ ਫੋਨ ਕੌਲ ਸੁਣਨ ਲੱਗ ਗਈ ਅਤੇ ਜਦੋਂ ਮੈਨੂੰ ਪਤਾ ਲ ਮੈਂ ਕੈਬ 'ਚੋਂ ਉਤਰੀ ਥੋੜ੍ਹੇ ਦੇਰ ਬਾਅਦ ਮੈਨੂੰ ਪਤਾ ਲੱਗਿਆ ਕਿ ਮੇਰੇ ਕੋਲ ਪਰਸ ਨਹੀਂ ਹੈ ਇਸ ਲਈ ਫਿਰ ਮੈਨੇ ਸਾਰਾ ਪਰਸ ਸਾਰੇ ਕਿਤੇ ਦੇਖਿਆ ਮੈਨੂੰ ਕਿਤੋਂ ਵੀ ਪਰਸ ਨਹੀਂ ਮਿਲਿਆ ਫੇਰ ਮੈਨੇ ਕੈਬ ਵਾਲੇ ਵੀਰੇ ਨੂੰ ਫੋਨ ਕੀਤਾ ਕਿ ਵੀਰ ਜੀ ਮੇਰਾ ਕੈਬ ਨਹੀਂ ਹੈ ਮੈਂ ਇਹ ਕਹਿਣਾ ਚਾਹੁੰਦੀ ਸੀ ਪਰ ਵੀਰ ਜੀ ਨੇ ਮੇਰਾ ਫੋਨ ਨਹੀਂ ਚੁੱਕਿਆ ਇਸ ਲਈ ਮੈਨੇ ਉਬਰ ਉਬਰ ਐਪ 'ਤੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਕੀ ਵੀਰ ਜੀ ਨੂੰ ਫੋਨ ਕਰਕੇ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਜਿਹੜੀ ਪਿਛਲੀ ਸਵਾਰੀ ਹੈਗੀ ਉਹਦਾ ਪਤਾ ਲਗਾਇਆ ਜਾਵੇ ਅਤੇ ਮੇਰਾ ਪਰਸ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਜਦੋਂ ਤੁਹਾਨੂੰ ਪਰਸ ਮਿਲ ਗਿਆ ਮੇਰਾ ਤਾਂ ਮੇਰੇ ਅਡਰੈਸ ਪਿੰਡ ਫਫੜੇ ਭਾਈ ਕੇ ਪਹੁੰਚਾਇਆ ਜਾਵੇ ਏ ਮੈਂ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਮੇਰੇ ਉਹ ਪਰਸ ਦੇ ਵਿੱਚ ਬਹੁਤ ਜ਼ਰੂਰੀ ਸਮਾਨ ਸੀ ਜਿਵੇਂ ਕਿ ਅਧਾਰ ਕਾਰਡ ਪੈੱਨ ਕਾਰਡ ਇਹ ਸਾਰਾ ਸਮਾਨ ਮੈਨੂੰ ਜ਼ਰੂਰਤ ਪੈਂਦੀ ਰਹਿੰਦੀ ਹੈ ਪੇਪਰਾਂ ਕਰਕੇ ਇਸਲਈ ਮੇਰਾ ਨਾ ਸਾਰਾ ਸਮਾਨ ਵੀ ਪਰਸ ਸਮੇਤ ਭੇਜਿਆ ਜਾਵੇ ਧੰਨਵਾਦ